ਹਾਂਜੀ ਮੈਂ ਚਿੱਤਰਕਾਰੀ ਦੀ ਕਲਾਸ ਲਗਾਈ ਹੈ ਜਿਹਦੇ 'ਚ ਮੇਰੇ ਟੀਚਰ ਨੇ ਮੈਨੂੰ ਅਲੱਗ ਅਲੱਗ ਚਿੱਤਰਕਾਰੀ ਦੇ ਬਾਰੇ ਦੱਸਿਆ ਹੈ ਸਕੂਲ ਵਿੱਚ ਮੈਂ ਇਸ ਦੀਆਂ ਕਲਾਸਾਂ ਲਾਉਂਦੀ ਰਹੀ ਹਾਂ ਅਤੇ ਜੇ ਜਦੋਂ ਉਹਨਾਂ ਕੋਲ ਟਾਈਮ ਹੁੰਦਾ ਸੀ ਘਰੇ 'ਤੇ ਮੈਂ ਉਹਨਾਂ ਦੇ ਘਰੇ ਜਾ ਕੇ ਜਿੱਦਾਂ ਟਿਊਸ਼ਨ ਚਿੱਤਰਕਾਰੀ ਦੀ ਲੈਂਦੀ ਸੀ ਜਿਹਦੇ ਨਾਲ ਕੀ ਮੈਨੂੰ ਜਿਹੜਾ ਆਪਣਾ ਚਿੱਤਰਕਾਰੀ ਦੇ ਅਨੁਭਵ ਬਾਰੇ ਬਹੁਤ ਜ਼ਿਆਦਾ ਪਤਾ ਲੱਗਿਆ ਉਹਦੇ ਬਾਰੇ ਕਿੱਦਾਂ ਕੀ ਕੀ ਕਰਨਾ ਹਰੇਕ ਬਰੀਕੀ ਬਾਰੇ ਪਤਾ ਲੱਗਿਆ ਅਤੇ ਮੈਂ ਇਹਦੀਆਂ ਔਨਲਾਈਨ ਕਲਾਸਾਂ ਵੀ ਲਗਾਈਆਂ ਨੇ ਜਿੱਦਾਂ ਜਿੱਦਾਂ ਉਹ ਮੈਨੂੰ ਦੱਸਦੇ ਸੀਗੇ ਬਣਾ ਕੇ ਕੀ ਫਸਟ ਸਟੈਪ ਇਹਦੇ ਬਹੁਤ ਜ਼ਿਆਦੇ ਸਟੈਪ ਹੁੰਦੇ ਨੇ ਅਤੇ ਉਦਾਂ ਉਹਦੀ ਪ੍ਰੈਕਟਿਸ ਕਰਨੀ ਪੈਂਦੀ ਹੈ ਰੋਜ਼ ਰੋਜ਼ ਜਿੱਦਾਂ ਆਪਾਂ ਇਹਦੀ ਰੋਜ਼ ਰੋਜ਼ ਪ੍ਰੈਕਟਿਸ ਕਰਦੇ ਹਾਂ ਉਦਾਂ ਉਦਾਂ ਆਪਾਂ ਨੂੰ ਉਹ ਜਿਹੜੀ ਚੀਜ਼ ਹੈਗੀ ਹੈ ਪੇਂਟਿੰਗ ਜਾਂ ਫਿਰ ਚਿੱਤਰਕਾਰੀ ਹੈਗੀ ਹੈ ਉਹ ਆਪਾਂ ਨੂੰ ਵਧੀਆ ਤਰੀਕੇ ਨਾਲ ਆਉਣ ਲੱਗਦੀ ਹੈ ਅਤੇ ਆਪਾਂ ਉਹਦੇ 'ਚ ਪਰਫੈਕਸ਼ਨ ਲੈ ਕੇ ਆਉਂਦੇ ਹਾਂ ਅਤੇ ਬਹੁਤ ਜ਼ਿਆਦੇ ਆਪਾਂ ਨੂੰ ਵਧੀਆ ਤਰੀਕੇ ਨਾਲ ਉਹਨੂੰ ਚੀਜ਼ ਨੂੰ ਕਿਵੇਂ ਬਣਾਉਣਾ ਹੈ ਉਹ ਪਤਾ ਲੱਗ ਜਾਂਦਾ ਹੈ ਹੁਣ ਦੇਖੋ ਜਿਵੇਂ ਪਹਿਲਾਂ ਪੈਨਸਿਲ ਦੀ ਕੀਤੀ ਜਾਂਦੀ ਹੈ ਚਿੱਤਰਕਾਰੀ ਅਤੇ ਅੱਗੇ ਫਿਰ ਕਲਰਸ ਦੀ ਕੀਤੀ ਜਾਂਦੀ ਹੈ ਓਦਾਂ ਆਪਾਂ ਨੂੰ ਅੱਗੇ ਤੋਂ ਅੱਗੇ ਸਟੈਪ ਹੈ ਜਿਹੜੇ ਕੀ ਆਪਾਂ ਕਰਦੇ ਹਾਂ ਜਿਹਦੇ ਨਾਲ ਆਪਾਂ ਨੂੰ ਬਹੁਤ ਜ਼ਿਆਦੇ ਅਨੁਭਵ ਮਿਲਦਾ ਏ ਅਤੇ ਆਪਾਂ ਹੋਰ ਵੀ ਅੱਗੇ ਕਿਸੇ ਨੂੰ ਸਿਖਾ ਸਕਦੇ ਹਾਂ ਅਤੇ ਆਪ ਵਧੀਆ ਤਰੀਕੇ ਨਾਲ ਸਿੱਖ ਹੋ ਜਾਂਦਾ ਹੈ